ਹਾਂਜੀ ਹਾਂਜੀ ਹਾਂਜੀ ਕਰਮਵੀਰ ਬੋਲਨ ਡਿਆ ਜੀ ਹਾਂਜੀ ਹਾਂਜੀ ਸਰ ਜੀ ਹਾਂਜੀ ਜੀ ਦੱਸੋ ਜੀ ਹੋਰ ਪਰਿਵਾਰ ਠੀਕ ਪਰਿਵਾਰ ਠੀਕ ਆ ਬੱਚ ਬੱਚੇ ਰਾਜੀ ਫਲਾਜੀ ਆ ਕੰਮ ਕੁੰਮ ਹੀ ਨਹੀਂ ਮੁੜ ਕੇ ਦੱਸਿਆ ਤੁਸੀਂ ਤਾਂ ਜੋ ਮੁੜ ਕੇ ਆਏ ਕੀ ਖ਼ਰਾਬ ਹੋ ਗਿਆ ਜੋ ਨਹੀਂ ਕੀ ਗੱਲ ਹੋ ਗਈ ਗੋਡੀ ਦੇ ਮਤਲਬ ਕਿ ਬੰਦੇ ਦੇ ਵਿੱਚ ਦੋ ਚਾਰ ਹੀ ਵਿੱਚ ਬਦਲੇ ਬਾਕੀ ਦੇ ਬੰਦੇ ਪਹਿਲਾਂ ਵਾਲੇ ਆਉਂਦੇ ਆ

ਨਹੀਂ ਮੈਂ ਤਾਂ ਉਦਾਂ ਉਹਦੇ ਵਿੱਚੋਂ ਰਿਹਾ ਤਾਂ ਮੈਂ ਉੱਥੇ ਹੀ ਉਤਰਾਂ ਵਿੱਚੋਂ ਮੈਨੂੰ ਨਾ ਘੰਟਾ ਕੁ ਜਾਣਾ ਪਿਆ ਕਿਤੇ

ਨਹੀਂ ਤੁਹਾਡੇ ਸਾਹਮਣੇ ਇੰਨੇ ਚਿਰ ਦਾ ਕੰਮ ਕਰੀ ਦਾ ਕਦੀ ਉਲਾਂਭੇ ਵਾਲੀ ਤਾਂ ਗੱਲ ਹੀ ਨਹੀਂ ਹੋਈ ਸਾਡੀ ਨਾ ਤੇ ਹੈ ਨਹੀਂ ਉਹ ਤਾਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਪਰ ਮਤਲਬ ਕਿ ਨਹੀਂ ਦੋਨਾਂ ਕਿੱਲਿਆਂ 'ਚੋਂ ਖ਼ਰਾਬ ਹੋਇਆ ਕਿ ਜਾਂ ਇੱਕੋ 'ਚ ਹੋਈ ਯਾਰ ਮੈਂ ਨਾ ਉਰਲੇ ਬੰਨੇ ਡਹੇ ਹੀਂ ਅਤੇ ਉਹ ਬੰਦੇ ਡਾਏ ਸੀ ਪਰਲੇ ਬੰਨੇ ਅਤੇ ਮੇਰੇ ਕੋਲ ਵੀ ਉਧਰਲੇ ਬੰਨੇ ਨਾ ਪੂਰਾ ਫੇਰਾ ਨਹੀਂ ਵੱਜਿਆ ਅਤੇ ਮੈਂ ਦੇਖਿਆ ਚਲ ਬੰਦੇ ਕੰਮ ਕਰਦੇ ਅੱਗੇ ਅਤੇ ਚੱਲ ਕਰ ਲੈਣਗੇ ਇਹਦੇ ਚੱਲ ਸ਼ਾਇਦ ਉਹਨਾਂ ਦਾ ਕੰਮ ਸਹੀ ਕਰ ਦੇਣਗੇ ਜਾਂ ਕਿੱਦਾਂ ਨਹੀਂ ਨਿਗਰਾਨੀ ਤਾਂ ਤੁਹਾਡੇ ਸਾਹਮਣੇ ਅੱਗੇ ਰੱਖੀ ਦੀ ਆ ਨਿਗਰਾਨੀ ਤੋਂ ਵਗੈਰ ਤਾਂ ਅਸੀਂ ਕਿਸੇ ਦਾ ਕੰਮ ਨਹੀਂ ਕਰਦੇ ਹੁਣ ਆਹ ਇਹ ਪਰਸੋਂ ਗਏ ਆ ਇੱਧਰ ਸ਼੍ਰੀ ਹਰਗੋਬਿੰਦਪੁਰ ਵੱਲ ਉੱਧਰ ਵੀ ਅਸੀਂ ਪੰਝੀ ਬੰਦੇ ਖੜ੍ਹੇ ਸੀ ਅਤੇ ਉਹਨਾਂ ਦਾ ਵੀ ਕੰਮ ਕਰਕੇ ਆਇਆ ਕਮਾਦ ਕਮੂਦ ਦਾ ਬੜਾ ਵਧੀਆ ਕੋਈ ਚੱਕਰ ਹੀ ਨਹੀਂ ਹੈ ਉਹਨਾਂ ਨੇ ਤਾਂ ਸਗੋਂ ਆਖਣ ਡਿਆਂ ਭਾਅ ਜੀ ਹੁਣ ਦੱਸਿਓ ਸਾਨੂੰ ਜਿੱਦਣ ਵਿਹਲੇ ਹੋਊਗੇ ਜਾਂ ਕੀ ਹਿਸਾਬ ਕਿਤਾਬ ਹੈ ਨਹੀਂ ਨਹੀਂ ਉਹ ਤਾਂ ਗੱਲ ਤੁਹਾਡੀ ਨਾਲ ਸਹਿਮਤ ਹੈ ਅਸੀਂ ਉਹ ਉਹਦਾ ਤਾਂ ਕੋਈ ਚੱਕਰ ਨਹੀਂ ਆ ਨਹੀਂ ਤਾਂ ਕੱਢ ਕੇ ਨਹੀਂ ਗਏ ਘਾਹ ਘੂਹ ਵਿੱਚੋਂ ਸਾਰਾ ਕੱਢ ਕੇ ਨਹੀਂ ਗਏ ਮੈਂ ਤਾਂ ਉਹਨਾਂ ਨੂੰ ਪੱਕੀ ਕਰਕੇ ਕਿਹਾ ਵੀ ਉਹਨਾਂ ਦਾ ਸਮਾਨ ਵਿੱਚੋਂ ਸਫਾਈ ਪੂਰੀ ਕਰਕੇ ਜਾਇਓ ਵੀ ਖ਼ਰਾਬ ਨਾ ਕੰਮ ਕਰਿਓ ਤੇ ਨਹੀਂ ਨਹੀਂ ਉਹ ਤਾਂ ਨਹੀਂ ਨਹੀਂ ਉਹ ਤਾਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇੰਨਾ ਚਿਰ ਅੱਗੇ ਵੀ ਤੁਹਾਡੇ ਸਾਹਮਣੇ ਆਉਂਦੇ ਹਾਂ ਕੋਈ ਚੱਕਰ ਨਹੀਂ ਉਹੋ ਜਿਹਾ ਹੁਣ ਬੰਦੇ ਵਿੱਚ ਕਹਿ ਰਹੇ ਨਾ ਗਰਮੀ ਦਾ ਕਰਕੇ ਲੇਬਰ ਬਹੁਤ ਘੱਟ ਮਿਲਣ ਡਈ ਹੈ ਅਤੇ ਲੇਬਰ ਦਾ ਚੱਕਰ ਕਰਕੇ ਫਿਰ ਹੁਣ ਤੁਹਾਨੂੰ ਪਤਾ ਜਿੱਥੇ ਕੰਮ ਫੜਿਆ ਭੁਗਤਾਉਣਾ ਪੈਂਦਾ ਬੰਦੇ ਵਿੱਚ ਦੋ ਚਾਰ ਕੋਈ ਨਵੇਂ ਪਾਉਣੇ ਪੈਂਦੇ ਸਾਨੂੰ ਨਹੀਂ ਨਹੀਂ ਉਹ ਤਾਂ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਅਤੇ ਉਹ ਤੇਰੀ ਗੱਲ ਕੋਈ ਅਤੇ ਬਾਕੀ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਆਪਣਾ ਧਿਆਨ ਰੱਖਿਆ ਕਰਾਂਗੇ ਕੋਈ ਗੱਲ ਨਹੀਂ ਇਹ ਨਹੀਂ ਕੋਈ ਚੱਕਰ ਤੇ ਇਹ ਵੀ ਪੇ ਪੇਮੈਂਟ ਸਾਡੀ ਪੁਆ ਦਿਓ ਫਿਰ ਉਹਨਾਂ ਨੂੰ ਦੇਣੀ ਜੋ

ਆਹ ਚਲੋ ਬੰਦੇ ਨਾ ਆਏ ਵਿੱਚੋਂ ਨਾ ਕਈਆਂ ਨੂੰ ਦੇਣੇ ਉਦਣ ਮੇਰੇ ਕੋਲੋਂ ਆਪਣੇ ਕੋਲੋਂ ਦੇਣੀ ਪਈ ਪੇਮੈਂਟ ਫਿਰ ਹਾਂ ਚਲੋ ਕੋਈ ਨਹੀਂ ਮੈਂ ਤੁਹਾਨੂੰ ਸਵੇਰੇ ਕਾਲ ਕਰਕੇ ਨਾ ਤੇ ਦੱਸ ਦੂਗਾ ਕੋਈ ਗੱਲ ਨਹੀਂ ਅੱਗੇ ਤੋਂ ਥੋੜ੍ਹਾ ਖਿਆਲ ਰੱਖਾਂਗੇ ਕੋਈ ਚੱਕਰ ਨਹੀਂ ਠੀ ਠੀਕ ਹੈ ਠੀਕ ਹੈ ਭਾਈ ਠੀਕ ਹੈ ਜੀ ਓਕੇ ਜੀ ਓਕੇ